ਬੇਸ਼ਕ ਚਿੱਤਰ ਚਿਤਰਾਂ ਵਿੱਚ ਸਹੀ ਅਨੁਪਾਤ ਅਤੇ ਸਰੀਰ ਵਿਗਿਆਨ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ ਚਿੱਤਰਾਂ ਵਿੱਚ ਮੌਜੂਦ ਤੱਤ ਜਿਹੜੇ ਕਿ ਸਾਨੂੰ ਸੋਚਾਂ ਵਿੱਚ ਮਜਬੂਰ ਕਰ ਦਿੰਦੇ ਹਨ ਚਿੱਤਰ ਕਲਾ ਇੱਕ ਅਜਿਹੀ ਹੈ ਜਿਸ ਨਾਲ ਸਾਨੂੰ ਸਮਾਜਿਕ ਪੁਰਾਣਿਕ ਸਾਰੀਆਂ ਇਤਿਹਾਸਿਕ ਘਟਨਾਵਾਂ ਦਾ ਪਤਾ ਵੀ ਲੱਗਦਾ ਹੈ ਅਤੇ ਚਿੱਤਰ ਨੂੰ ਅਸੀਂ ਇੱਕ ਸਰੀਰ ਦੀ ਤਰ੍ਹਾਂ ਵੀ ਚਿਤਰਿਤ ਕਰ ਸਕਦੇ ਹਾਂ ਜੇਕਰ ਅਸੀਂ ਉਸ ਦੇ ਬਾਰੇ ਪੂਰੀ ਤਰੀਕੇ ਨਾਲ ਸੋਚੀਏ ਇਸ ਤਰ੍ਹਾਂ ਹੀ ਸਾਰੇ ਨਿਰਦੇਸ਼ਾਂ ਨਾਲ ਜੇ ਅ ਅਸੀਂ ਆਪਣੇ ਟੂਲ ਨੂੰ ਪ੍ਰਯੋਗ ਕਰਕੇ ਇੱਕ ਚਿੱਤਰ ਨੂੰ ਕੱਢਿਆ ਜਾਵੇ ਤਾਂ ਉਹ ਹੋਰ ਵੀ ਸੋਹਣਾ ਬਣ ਜਾਂਦਾ ਹੈ ਇਸ ਲਈ ਇੱਕ ਚਿੱਤਰਕਲਾ ਵਾਲੇ ਨੂੰ ਇਹ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਜਦੋਂ ਉਹ ਚਿੱਤਰ ਬਣਾਉਂਦਾ ਹੋਵੇ ਤਾਂ ਉਸ ਦਾ ਪੂਰਾ ਧਿਆਨ ਉਸ ਚਿੱਤਰ ਦੇ ਬਾਰੇ ਹੀ ਲੱਗਿਆ ਰਹੇ ਚਿੱਤਰ ਵਿੱਚ ਚਿੱਤਰ ਨੂੰ ਅਸੀਂ ਇਸ ਕਰਕੇ ਚਿੱਤਰਦੇ ਹਾਂ ਕਿਉਂਕਿ ਜੇਕਰ ਪੁਰਾਣੀਆਂ ਯਾਦਾਵਾਂ ਨੂੰ ਅਸੀਂ ਸੰਜੋੜ ਕੇ ਲੈ ਕੇ ਆਈਏ ਤਾਂ ਉਸ ਨੂੰ ਦੂਜਿਆਂ ਅੱਗੇ ਪ੍ਰਦਰਸ਼ਿਤ ਕਰੀਏ ਚਿੱਤਰਾਂ ਨੂੰ ਅਸੀਂ ਜ਼ਰੂਰ ਇੱਕ ਅਨੋਖਾ ਰੂਪ ਦੇ ਸਕਦੇ ਹਾਂ ਜੇ ਚਿੱਤਰਕਾਰ ਵਾਲੇ ਦੇ ਹੱਥ ਵਿੱਚ ਫੜੀ ਹੋਈ ਕਲਮ ਉਸ ਦੇ ਦਿਮਾਗ ਨਾਲ ਸਿੱਧਾ ਸੰਪਰਕ ਕਰੇ ਚਿੱਤਰਕਲਾ ਇੱਕ ਬਹੁਤ ਹੀ ਅਨੋਖੀ ਕਲਾ ਹੈ ਜਿਹੜਾ ਕਿ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਇਸ ਲਈ ਤਾਂ ਕਈ ਲੋਕ ਖੁਸ਼ ਹੋ ਕੇ ਚਿੱਤਰਕਲਾ